ਪੰਜਾਬ ਦੇ ਵਿੱਚ ਟੈਕਨੋਲਜੀ ਸੈਕਟਰ ਦੇ ਵਿੱਚ ਸਾਡੇ ਕੋਲ ਜੇ ਅਸੀਂ ਐਗਰੀਕਲਚਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਾਡੇ ਕੋਲ ਜਿਸ ਤਰ੍ਹਾਂ ਪਹਿਲਾਂ ਪੰਜਾਬ ਦੇ ਵਿੱਚ ਹੱਥਾਂ ਨਾਲ ਖੇਤੀ ਕੀਤੀ ਜਾਂਦੀ ਸੀ ਇਹ ਜੇ ਟਰੈਕਟਰ ਦਾ ਬਹੁਤ ਹੀ ਲਾਹੇਵੰਦ ਉਪਰਾਲਾ ਹੈ ਇਹਦੇ ਨਾਲ ਤੁਹਾਡਾ ਕਾਫ਼ੀ ਸਮਾਂ ਵੀ ਬਚਦਾ ਹੈ ਔਰ ਮਿਹਨਤ ਵੀ ਘੱਟ ਕਰਨੀ ਪੈਂਦੀ ਹੈ ਔਰ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਜਾ ਸਕਦਾ ਹੈ ਜਿਵੇਂ ਕਿ ਹੁਣ ਇਸ ਦੋ ਸਾਲਾਂ ਦੇ ਵਿੱਚ ਨਵੇਂ ਗੌਰਮਿੰਟ ਵੱਲੋਂ ਪ੍ਰੋਜੈਕਟ ਭੇਜੇ ਗਏ ਹਨ ਜਿਵੇਂ ਕਿ ਟਰੈਕਟਰਾਂ ਦੇ ਵਿੱਚ ਸੁਪਰ ਸੀਡਰ ਹੈ ਉਹਦੇ ਵਿੱਚ ਮੈਨਪਾਵਰ ਵੀ ਘੱਟ ਜਾਂਦੀ ਹੈ ਦੋ ਚਾਰ ਬੰਦਿਆਂ ਦਾ ਕੰਮ ਵੀ ਇਕੱਠਾ ਕਰਦਾ ਹੈ ਅਤੇ ਉਹ ਕੰਮ ਜਿਹੜਾ ਜ਼ਿਆਦਾ ਖਰਚੇ ਵਿੱਚ ਜ਼ਿਆਦਾ ਖਪਤਕਾਰ ਡੀਜਲ ਦੀ ਖਪਤ ਕਰਕੇ ਜੋ ਹੁੰਦਾ ਸੀ ਉਹ ਥੋੜ੍ਹੇ ਸਮੇਂ ਦੇ ਵਿੱਚ ਹੀ ਕੀਤਾ ਜਾ ਸਕਦਾ ਹੈ ਜਿਵੇਂ ਸੁਪਰ ਸੀਡਰ ਹੋ ਗਿਆ ਰੋਟਾਵੇਟਰ ਹੋ ਗਿਆ ਅਤੇ ਅਤੇ ਸੋਲਰ ਸਿਸਟਮ ਹੋ ਗਿਆ ਇਹਦੇ ਵਿੱਚ ਕਿਸਾਨਾਂ ਨੂੰ ਐਗਰੀਕਲਚਰ ਦੇ ਵਿੱਚ ਬਹੁਤ ਹੀ ਫ਼ਾਇਦਾ ਅਤੇ ਉਸ ਤੋਂ ਵੀ ਅੱਗੇ ਗੱਲ ਜੋ ਹੈ ਚਿੱਠੀ ਪੱਤਰ ਦੀ ਗੱਲ ਹੈ ਪਹਿਲਾਂ ਚਿੱਠੀ ਪਾਈ ਜਾਂਦੀ ਸੀ ਮੈਸੇਜ ਦਿੱਤਾ ਜਾਂਦਾ ਸੀ ਹੁਣ ਜੋ ਈਮੇਲ ਹੈ ਫੂਨ ਦੇ ਰਾਹੀਂ ਜਾਂ ਕੰਪਿਊਟਰ ਦੇ ਰਾਹੀਂ ਅਸੀਂ ਇੱਕ ਮੈਸੇਜ ਦੂਸਰੇ ਨੂੰ ਬੜੀ ਕੁਝ ਪਲਾਂ ਦੇ ਵਿੱਚ ਹੀ ਭੇਜ ਸਕਦੇ ਹਾਂ ਅਤੇ ਅਗਲੇ ਦੀ ਗੱਲ ਸੁਣ ਸਕਦੇ ਹਾਂ ਤਾਂ ਅਗਲੇ ਨੂੰ ਮੈਸੇਜ ਦੇ ਸਕਦੇ ਹਾਂ ਜਾਂ ਅਗਲੇ ਦਾ ਮੈਸੇਜ ਪੜ੍ਹ ਸਕਦੇ ਹਾਂ ਲਿਖ ਸਕਦੇ ਹਾਂ ਇੱਕ ਬਹੁਤ ਹੀ ਵਧੀਆ ਗੱਲ ਹੈ ਅਤੇ ਉਸ ਤੋਂ ਬਾਅਦ ਹੈ ਆਪਣਾ ਇਹੋ ਹੀ ਚਲੋ ਠੀਕ ਹੈ